ਮੋਹਾਲੀ ਜ਼ਿਲ੍ਹੇ ਵਿੱਚ ਪੇਂਡੂ ਖੇਤਰ ਦਾ ਰੋਜ਼ੀ ਰੋਟੀ ਦਾ ਮੁੱਖ ਸਰੋਤ ਖੇਤੀਬਾੜੀ ਹੈ ਨਾਲ਼ ਹੀ ਪਸ਼ੂ ਪਾਲਣ ਵੀ ਰੁਜ਼ਗਾਰ ਦਾ ਸਾਧਨ ਹੈ ਸ਼ਹਿਰੀ ਲੋਕ ਚੰਡੀਗੜ੍ਹ ਨੇੜੇ ਹੋਣ ਕਾਰਨ ਬਹੁਤ ਹੱਦ ਤੱਕ ਨਿੱਜੀ ਨੌਕਰੀਆਂ ਕਰਦੇ ਹਨ ਅਤੇ ਅੱਜ ਕੱਲ੍ਹ ਦੇ ਨੌਜਵਾਨ ਜ਼ਿਆਦਾਤਰ ਵਿਦੇਸ਼ ਜਾਣ ਨੂੂੰ ਤਰਜੀਹ ਦਿੰਦੇ ਹਨ ਚੰਡੀਗੜ੍ਹ ਨੇੜੇ ਹੋਣ ਦੇ ਬਾਵਜੂਦ ਵੀ ਇੱਥੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਮੇਰਾ ਸੁਝਾਅ ਇਹ ਹੈ ਕਿ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਠੋਸ ਕਦਮ ਚੁੱਕੇ ਜਾਣ